ਡਰਾਇੰਗ ਵਿੱਚ ਯਥਾਰਥਵਾਦ ਸੰਦਰਭ ਦੇ ਆਧਾਰ 'ਤੇ ਮਹੱਤਵਪੂਰਨ ਹੋ ਸਕਦਾ ਹੈ ਪਰ ਇਸ ਨੂੰ ਰਚਨਾਤਮਕਤਾ ਨਾਲ ਸੰਤੁਲਿਤ ਕਰਨਾ ਤੁਹਾਡੀ ਤੁਹਾਡੀ ਕਲਾਕਾਰੀ ਨੂੰ ਵਧੇਰੇ ਵਿਅਕਤੀਗਤ ਅਤੇ ਭਾਵਪੂਰਨ ਬਣਾਉਣ ਦੀ ਕੁੰਜੀ ਹੈ ਯਥਾਰਥਵਾਦ ਸ਼ੁੱਧਤਾ ਦੀ ਪੇਸ਼ਕਸ਼ ਕਰਦਾ ਹੈ ਪਰ ਰਚਨਾਤਮਕਤਾ ਵਿਕ ਵਿਲੱਖ ਵਿਖਲੱਕਣ ਵਿਖਿਆਵਾਂ ਅਤੇ ਡੁੰਘਾਈ ਦੀ ਆਗਿਆ ਦਿੰਦੀ ਹੈ ਇਹ ਦਰਸ਼ਕ ਨੂੰ ਐਂਕਰ ਕਰਨ ਲਈ ਯਥਾਰਤਵਾਦੀ ਯ ਤੱਤਾਂ ਦੀ ਵਰਤੋਂ ਕਰਨ ਦਾ ਤਰੀਕਾ ਲੱਭਣ ਬਾਰੇ ਹੈ ਜਦੋਂ ਕਿ ਕਲਪਨਾਤਮਕ ਯਹਾਂਪਰ ਪ੍ਰਤੀ ਆਤਮਕ ਭਾਗਾਂ ਨੂੰ ਵੀ ਪੇਸ਼ ਕਰਨਾ ਹੈ ਜੋ ਟੁਕੜੇ ਵਿੱਚ ਪਰਤਾਂ ਜੋੜਦੇ ਹਨ ਡਰਾਇੰਗਾਂ ਵਿੱਚ ਭਾਵਨਾਵਾਂ ਅਤੇ ਭਾਵਨਾਵਾਂ ਨੂੰ ਸ਼ਾਮਲ ਕਰਨਾ ਅਕਸਰ ਤਕਨੀਕ ਦੁਆਰਾ ਹੁੰਦਾ ਹੈ ਇੱਕ ਖ਼ਾਸ ਮੁੱਢ ਨੂੰ ਪੈਦਾ ਕਰਨ ਲਈ ਰੰਗ ਟੈਕਸ ਅਤੇ ਰਚਨਾ ਦੀ ਵਰਤੋਂ ਕਰਦੇ ਹਨ